ਮੈਂ ਇਹ ਚੀਜ਼ ਦੇ ਉੱਤੇ ਬਿਲਕੁਲ ਸਹਿਮਤ ਹਾਂ ਪਾਣੀ ਦੀ ਸਪਲਾਈ ਬਿਲਕੁਲ ਮਿਲਦੀ ਹੈ ਅਤੇ ਸਾਨੂੰ ਪੰਜਾਬ ਦੇ ਅੰਦਰ ਜੋ ਅਸੀਂ ਬਤੀਤ ਕਰ ਰਹੇ ਹਾਂ ਆਪਣਾ ਜੀਵਨ ਉਹ ਬਹੁਤ ਵਧੀਆ ਬਤੀਤ ਕਰ ਰਹੇ ਹਾਂ ਕਿਉਂਕਿ ਪਾਣੀ ਤਾਂ ਇੱਕ ਸਮੱਸਿਆ ਜਿਹੜੀ ਕਿੱਥੇ ਇਹ ਨਹੀਂ ਕਹਿ ਸਕਦਾ ਕਿ ਸਾਰੇ ਤਰਫ ਪੰਜਾਬ ਨ ਪਾਣੀ ਸਪਲਾਈ ਹੈ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਉਹਦੇ ਅੰਦਰ ਬਹੁਤ ਵਧੀਆ ਪਾਣੀ ਸਪਲਾਈ ਮਿਲਦਾ ਅਤੇ ਬਿਲਕੁਲ ਪਾਣੀ ਸਾਫ ਆਉਂਦਾ ਅਗਰ ਪਾਣੀ ਸਾਫ ਆਏਗਾ ਤਾਂ ਹੀ ਸਾਡਾ ਜੀਵਨ ਵਧੀਆ ਚੱਲੇਗਾ ਅਤੇ ਇਸ ਲਈ ਘਰ ਘਰ ਅੱਜ ਦੀ ਡੇਟ 'ਚ ਕੁਝ ਫਿਲਟਰ ਵੀ ਲਗਾਏ ਗਏ ਨੇ ਜਿਹਦੇ ਨਾਲ ਉਹ ਪਾਣੀ ਦੀ ਕਲੈਰਟੀ ਔਰ ਅੱਛਾ ਸਾਫ ਪਾਣੀ ਅਸੀਂ ਡਰਿੰਕ ਕਰ ਸਕੀਏ ਅਤੇ ਨਾਲ ਪਾਣੀ ਇੱਕ ਜੀਵਨ ਦੇ ਨਾਲ ਜੁੜਿਆ ਹੋਇਆ ਹੈਗਾ ਜੋ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਦੇ ਬਿਨਾ ਅਸੀਂ ਕਿੱ ਨਹੀਂ ਸਰਵਾਈਵ ਕਰ ਸਕਦੇ ਆ ਅਤੇ ਪਾਣੀ ਦੀ ਸਪਲਾਈ ਅਤੇ ਪਾਣੀ ਦਾ ਜਿਹੜਾ ਇੰਪੈਕਟ ਹੈ ਜਿਹੜਾ ਕਾਰਨ ਹੈ ਉਹ ਬਹੁਤ ਜ਼ਰੂਰੀ ਹੈ ਅਤੇ ਪਾਣੀ ਸਾਫ ਹੋਣਾ ਚਾਹੀਦਾ ਪਹਿਲੇ ਪ੍ਰਿਓਰਟੀ ਹੈ ਅਤੇ ਸਾਰਾ ਫੀਡਬੈਕ ਮੇਰੀ ਤਰਫੋਂ ਪਹਿਲੇ ਵੀ ਦਿੱਤਾ ਮੈਂ ਹੁਣ ਦੁਬਾਰਾ ਦੇਣਾ ਚਾਹੂੰਗਾ ਪਾਣੀ ਬਹੁਤ ਵਧੀਆ ਜੀ ਅਤੇ ਪਾਣੀ ਦੀ ਸਪਲਾਈ ਇੱਥੇ ਹੈਵ ਹੈਗੀ ਹੈ ਜੀ